ਪੰਜਾਬ ਦੀਆਂ ਮਸ਼ਹੂਰ ਖੇਡਾਂ ਹਾਕੀ ਅਤੇ ਕਬੱਡੀ ਨੇ ਹਾਕੀ ਵਿੱਚ ਸਾਡੇ ਪੰਜਾਬ ਤੋਂ ਬਹੁਤ ਸਾਰੇ ਸਿੱਖ ਖਿਡਾਰੀ ਹੋਏ ਨੇ ਬੜੀਆਂ ਨਾਵਾਂ ਖੱਟੀਆਂ ਨੇ ਅੱਜ ਕੱਲ੍ਹ ਇਹਨਾਂ ਸਾਰੀਆਂ ਖੇਡਾਂ ਦੀ ਥਾਂ ਕ੍ਰਿਕਟ ਬੈਡਮਿੰਟਨ ਟੈਂਨਿਸ ਫੁੱਟਬਾਲ ਵਰਗੀਆਂ ਖੇਡਾਂ ਨੇ ਲੈ ਲਈ ਟੀਵੀ ਦੇ ਪ੍ਰਭਾਵ ਹੇਠ ਲੋਕ ਅੱਜ ਕੱਲ੍ਹ ਕ੍ਰਿਕਟ ਨੂੰ ਜ਼ਿਆਦਾ ਪਸੰਦ ਕਰਦੇ ਨੇ ਪਰ ਕ੍ਰਿਕਟ ਖੇਡ ਪੈਸੇ ਲਈ ਜ਼ਿਆਦਾ ਖੇਡੀ ਜਾਂਦੀ ਹੈ ਮਨੋਰੰਜਨ ਲਈ ਘੱਟ ਅੱਜ ਕੱਲ੍ਹ ਬੱਚੇ ਘਰਾਂ ਵਿੱਚ ਹੀ ਫੋਨਾਂ 'ਤੇ ਖੇਡਾਂ ਖੇਡਦੇ ਨੇ ਇਹ ਬਹੁਤ ਗਲਤ ਹੈ ਕਿਉਂਕਿ ਫਿਜੀਕਲ ਐਕਸਰਸਾਈਜ਼ ਬਹੁਤ ਘੱਟ ਗਈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਨੂੰ ਇਹਨਾਂ ਵੱਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਪੰਜਾਬ ਵਿੱਚੋਂ ਵਧੀਆ ਖਿਡਾਰੀ ਤਿਆਰ ਕਰਕੇ ਨੈਸ਼ਨਲ ਤੱਕ ਲੈ ਕੇ ਜਾਈਏ ਅਤੇ ਆਪਣੇ ਪੰਜਾਬ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਚਮਕਾਈਏ ਪਹਿਲੇ ਸਮੇਂ ਵਿੱਚ ਲੋਕ ਜਦੋਂ ਆਪਣੇ ਕੰਮਾਂਕਾਰਾਂ ਤੋਂ ਵਿਹਲੇ ਹੁੰਦੇ ਸੀ ਤਾਂ ਆਪਣੇ ਪਿੰਡਾਂ ਵਿੱਚ ਕੁਸ਼ਤੀ ਕਬੱਡੀ ਦੌੜਾਂ ਕਰਵਾਉਂਦੇ ਸੀ ਅਤੇ ਆਪਣੇ ਮੰਨੋਰੰਜਨ ਕਰਦੇ ਸਨ ਸਾਰਿਆਂ ਵਿੱਚ ਬਹੁਤ ਪਿਆਰ ਵੱਧਦਾ ਸੀ ਅੱਜ ਕੱਲ੍ਹ ਜਿੱਤਣ ਹਾਰਨ ਵਿੱਚ ਦੁਸ਼ਮਣੀਆਂ ਵਧੀਆਂ ਨੇ ਜਿੱਤਣ ਲਈ ਬੱਚੇ ਨਸ਼ੇ ਦਾ ਸਹਾਰਾ ਲੈਂਦੇ ਨੇ ਇਹ ਬਹੁਤ ਗਲਤ ਹੈ ਅਤੇ ਚਿੰਤਾ ਦਾ ਵਿਸ਼ਾ ਹੈ ਪਹਿਲੇ ਸਮੇਂ ਵਿੱਚ ਲੋਕ ਦੇਸੀ ਖੁਰਾਕਾਂ ਖਾਂਦੇ ਸੀ ਅਤੇ ਘੋੜਸਵਾਰੀ ਵਰਗੀਆਂ ਖੇਡਾਂ ਖੇਡਦੇ ਸੀ ਪਰ ਅੱਜ ਕੱਲ੍ਹ ਬੱਚੇ ਗੱਡੀਆਂ ਵੱਲ ਭੱਜਦੇ ਨੇ ਇਹ ਖੇਡਾਂ ਤਾਂ ਸਿਰਫ ਸਕੂਲਾਂ ਤੱਕ ਹੀ ਸੀਮਤ ਰਹਿ ਗਈਆਂ ਨੇ